ਭੰਗੜੇ ਦੇ ਪ੍ਰਦਰਸ਼ਨ ਲਈ ਪਹਿਨੇ ਜਾਣ ਵਾਲੇ ਪਹਿਰਾਵੇ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਚੁਣਿਆ ਜਾਂਦਾ ਹੈ ਇਹ ਪਹਿਰਾਵਾ ਨਾ ਸਿਰਫ ਨਾਚ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਸਗੋਂ ਨਾਚ ਕਰਨ ਵਾਲਿਆਂ ਨੂੰ ਇੱਕ ਵਿਸ਼ੇਸ਼ ਪਹਿਛਾਣ ਦੀ ਦਿੰਦਾ ਹੈ ਆਮ ਤੌਰ ਤੇ ਭੰਗੜੇ ਲਈ ਪਹਿਨੇ ਜਾਣ ਵਾਲੇ ਪਹਿਰਾਵੇ ਵਿੱਚ ਹੇਠ ਲਿਖੇ ਤੱਤ ਸ਼ਾਮਿਲ ਹੁੰਦੇ ਮਰਦਾਂ ਕੁੜਤਾ ਚਮਕਦਾਰ ਰੰਗਾਂ ਵਾਲਾ ਕੁੜਤਾ ਜਿਸ ਵਿੱਚ ਕਢਾਈ ਜਾ ਬੂਟੇ ਪਜਾਮਾ ਚਿੱਟਾ ਜਿਹਾ ਕਰੀ ਲੱਗਦਾ ਪਜਾਮਾ ਜੁੱਤੀ ਖੁਸੇ ਜਾ ਕਿੱਲੇ ਦਾ ਜੁੱਤੀਆਂ ਪਗੜੀ ਰੰਗੀਨ ਪਗੜੀ ਜੋ ਸਿਰ ਨੂੰ ਸਿੰਗਾਰਦੀ ਹੈ ਸ਼ਿੰਗਾਰਦੀ ਹੈ ਔਰਤਾਂ ਲਈ ਸੂਟ ਚਮਕਦਾਰ ਰੰਗਾ ਵਾਲਾ ਸੂਟ ਜਿਸ ਵਿੱਚ ਗੋਟੇ ਜਾ ਕਢਾਈ ਹੋਵੇ ਚੂੜੀਆਂ ਕੰਨਾਂ ਵਿੱਚ ਝੁਮਕੇ ਅਤੇ ਹੱਥਾਂ ਵਿੱਚ ਚੁੜੀਆ ਜੁੱਤੀਆਂ ਚਮਕਦਾ ਜੁੱਤੀਆਂ ਜਾਂ ਕਲਾਵਾਂ ਇਹ ਪੋਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਾਰਸ਼ਕ ਕਿਵੇਂ ਬਣਾਉਂਦੇ ਹਨ ਚਮਕਦਾ ਰੰਗ ਚਮਕਦਾ ਰੰਗਾ ਵਾਲੇ ਪਹਿਰਾਵੇ ਨਾਚ ਕਰਨ ਵਾਲਿਆਂ ਨੂੰ ਭੀੜ ਵਿੱਚੋਂ ਵੱਖਰਾ ਦਿਖਾਉਂਦਿਆਂ ਹਨ ਅਤੇ ਉਹਨਾਂ ਦੀਆਂ ਹਰਕਤਾਂ ਨੂੰ ਹੋਰ ਵੀ ਨਜ਼ਰ ਆਉਂਦਾ ਬਣਾਉਂਦੇ ਹਨ ਕਢਾਈ ਅਤੇ ਬੂਟੇ ਕਢਾਈ ਅਤੇ ਬੂਟੇ ਪਹਿਰਾਵੇ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ ਅਤੇ ਨਾਚ ਕਰਨ ਵਾਲਿਆਂ ਨੂੰ ਸ਼ਖਸ਼ੀਅਤ ਨੂੰ ਦਰਸਾਉਂਦੇ ਹਾਂ ਪਗੜੀ ਪਗੜੀ ਮਰਦਾਂ ਨੂੰ ਇੱਕ ਵਿਸ਼ੇਸ਼ ਅਤੇ ਮਰਦਾਨਾ ਲੁਕ ਦਿੰਦੀ ਹੈ ਚੂੜੀਆਂ ਅਤੇ ਝੁਮਕੇ ਚੂੜੀਆਂ ਅਤੇ ਝੁਮਕੇ ਔਰਤਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਅਤੇ ਉਨਾਂ ਨੂੰ ਇੱਕ ਨਾਰੀਲੀ ਸ਼ੋਅ ਦਿੰਦੇ ਹਨ ਜੁੱਤੀਆਂ ਜੁੱਤੀਆਂ ਨਾਚ ਕਰਨ ਵਾਲਿਆਂ ਨੂੰ ਰਾਮਦਾਇਕ ਅਤੇ ਮੁਕਾਮਾਲ ਲੁਕ ਦਿੰਦਿਆਂ ਹਨ ਇਹ ਸਾਰੇ ਤੱਤ ਮਿਲ ਕੇ ਭੰਗੜੇ ਦੇ ਪ੍ਰਦਰਸ਼ਨ ਨੂੰ ਹੋਰ ਵੀ ਰੰਗੀਨ ਅਤੇ ਜੀਵੰਤ ਬਣਾਉਂਦੇ ਹਨ